ਮੇਰੇ ਅਕੋਰਡਿੰਗ ਬਹੁਤ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਨੌਜਵਾਨਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਖੇਡਾਂ ਖੇਡਣ ਲਈ ਕਿਉਂਕਿ ਉਹਨਾਂ ਨੂੰ ਸਿਰਫ ਇਹ ਲੱਗਦਾ ਹੈਗਾ ਕਿ ਖੇਡਾਂ ਖੇਡਣੀਆਂ ਇੱਕ ਮਨੋਰੰਜਨ ਦਾ ਸਾਧਨ ਹੈ ਪਰ ਇਹ ਗਲਤ ਹੈ ਮਨੋਰੰਜਨ ਇਹ ਸਿਰਫ ਇਕੱਲਾ ਮਨੋਰੰਜਨ ਦਾ ਸਾਧਨ ਨਹੀਂ ਬਲਕੀ ਇਹ ਸਾਡੇ ਸਰੀਰ ਲਈ ਵੀ ਫਾਇਦੇਮੰਦ ਨੇਗੀਆਂ ਜਿਵੇਂ ਇਹਦੇ ਨਾਲ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਹੈਗੀਗੀ ਜਿਹਦੇ ਨਾਲ ਸਾਡਾ ਜਿਹੜਾ ਮਾਇੰਡ ਆ ਉਹ ਵੀ ਫਰੈਸ਼ ਰਹਿੰਦਾ ਗਾ ਅਤੇ

ਥਾਵਾਂ ਅਜਿਹੀਆਂ ਵੀ ਨੇ ਜਿੱਥੇ ਬੱਚਿਆਂ ਨੂੰ ਵੀ ਖੇਡਣ ਲਈ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਹੈਗਾ ਗਾ ਉਹ ਹਰ ਵਕਤ ਪੜ੍ਹਾਈ ਦੇ ਵਿੱਚ ਰਹਿੰਦੇ ਨੇਗੇ ਅਤੇ ਪਰ ਇਹ ਗੱਲ ਗਲਤ ਹੈਗੀ ਕਿਉਂਕਿ ਸਾਰਾ ਦਿਨ ਪੜ੍ਹਾਈ ਕਰ ਪੜ੍ਹਾਈ ਵੀ ਜ਼ਰੂਰੀ ਨਹੀਂ ਹੈਗੀਗੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਣੀਆਂ ਵੀ ਬਹੁਤ ਜ਼ਰੂਰੀ ਨੇਗੀਆਂ ਉਹ ਸਾਨੂੰ ਬਹੁਤ ਲਾਭ ਦਿੰਦੀਆਂ ਨੇਗੀਆਂ ਖੇਡਾਂ ਦੇ ਵਿੱਚ ਜਿਵੇਂ ਰੱਸੀ ਰੱਸੀ ਕੁੱਦਨਾ ਖੇਡਾਂ ਹੋਰ ਬੋ ਜਿਵੇਂ ਬੋਲੀਵਾਲ ਫੁੱਟਬਾਲ ਖੋ ਖੋ ਅਜਿਹੀਆਂ ਖੇਡਾਂ ਸਾਨੂੰ ਖੇਡਣੀਆਂ ਚਾਹੀਦੀਆਂ ਨੇਗੀਆਂ ਅਤੇ ਕਈ ਸਕੂਲਾਂ ਦੇ ਵਿੱਚ ਇਹਨਾਂ ਦਾ ਸਮਾਨ ਦਾ ਵੀ ਪ੍ਰਬੰਧ ਨਹੀਂ ਹੈਗਾ ਗਾ ਅਤੇ ਮੇਰੇ ਅਕੋਰਡਿੰਗ ਸਾਰੀਆਂ ਕਿਤੇ ਸਮਾਨ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਗਾ ਧੰਨਵਾਦ